ਮੈਂ ਰੋਪੜ ਥੋਕ ਬਜ਼ਾਰ ਵਿੱਚ ਗਿਆ ਸੀ ਉੱਥੋਂ ਮੈਂ ਉਨ੍ਹਾਂ ਤੋਂ ਰੇਟ ਪੁੱਛੇ ਅਤੇ ਰੇਟ ਮੈਨੂੰ ਵਾਜਬ ਨਹੀਂ ਲੱਗੇ ਇਸ ਕਰਕੇ ਮੈਂ ਛੋਟੀਆਂ ਮਾਰਕੀਟਾਂ ਵਿੱਚ ਗਿਆ ਸੀਗਾ ਉੱਥੇ ਮੈਂ ਮੈਨੂੰ ਰੇਟ ਪਸੰਦ ਆਏ ਉੱਥੋਂ ਮੈਂ ਕਰਿਆਨਾ ਖਰੀਦ ਕੇ ਰੋਪੜ ਥੋਕ ਬਾਜ਼ਾਰ ਤੋਂ ਲੈ ਕੇ ਸਬਜ਼ੀਆਂ ਦੇ ਸਬਜ਼ੀਆਂ ਦੇ ਰੇਟ ਬਹੁਤ ਕੀਮਤਾਂ ਪਹਿਲੇ ਨਾਲੋਂ ਇਸ ਟਾਈਮ ਵੱਧ ਚੱਲ ਰਹੀਆਂ ਹਨ ਕਿ ਜੋ ਪੰਜਾਹ ਰੁਪਏ ਦੇ ਰੇਟ ਤੋਂ ਉੱਪਰ ਅੱਜ ਕੱਲ੍ਹ ਕੋਈ ਵੀ ਸਬਜ਼ੀ ਨਹੀਂ ਮਿਲਦੀ